ਦੋ ਲੱਖ ਤੀਹ ਹਜ਼ਾਰ ਚਾਰ ਸੌ ਪੰਜਾਹ ਤਿੰਨ ਲੱਖ ਪੰਤਾਲੀ ਹਜ਼ਾਰ ਦੋ ਸੌ ਛਪੰਜਾ ਚਾਰ ਲੱਖ ਵੀਹ ਹਜ਼ਾਰ ਤਿੰਨ ਸੌ ਸੱਠ ਸੱਤ ਲੱਖ ਪੱਚੀ ਹਜ਼ਾਰ ਨੌ ਸੌ ਪੰਜਾਹ ਅੱਠ ਲੱਖ ਪੰਜਾਹ ਹਜ਼ਾਰ ਤਿੰਨ ਸੌ ਇੱਕੀ